ਰਵਾਇਤੀ ਤੌਰ 'ਤੇ ਜੇਕਰ ਅਸੀਂ ਲਿਖਣ ਦੀ ਗੱਲ ਕਰੀਏ ਤਾਂ ਪਹਿਲਾਂ ਲੋਕ ਫੱਟੀ ਦੇ ਉੱਪਰ ਸਿਆਹੀ ਦੇ ਨਾਲ ਅਤੇ ਕਲਮ ਦੀ ਵਰਤੋਂ ਕਰਕੇ ਲਿਖਦੇ ਸੀ ਉਸ ਤੋਂ ਅ ਅਤੇ ਉਸ ਤੋਂ ਬਾਅਦ ਸਲੇਟ ਦੀ ਸਲੇਟੀ ਦੇ ਨਾਲ ਸਲੇਟ ਦੀ ਵੀ ਵਰਤੋਂ ਕਰਦੇ ਰਹੇ ਪ੍ਰੰਤੂ ਅੱਜ ਕੱਲ੍ਹ ਦੇ ਵਿਦਿਆਰਥੀਆਂ ਨੂੰ ਇਹਨਾਂ ਚੀਜ਼ਾਂ ਬਾਰੇ ਕੁਛ ਵੀ ਪਤਾ ਨਹੀਂ ਹੈ ਸੋ ਮੁੱਖ ਤੌਰ 'ਤੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਕਾਪੀ ਦੇ ਉੱਪਰ ਪੈੱਨ ਦੇ ਨਾਲ ਹੀ ਲਿਖਿਆ ਜਾਂਦਾ ਹੈ ਅਤੇ ਇਹ ਲਿਖਣ ਦਾ ਇੱਕ ਚੰਗਾ ਤਰੀਕਾ ਵੀ ਹੈ ਇਹਦੇ ਨਾਲ ਬੰਦਾ ਜੋ ਸਾਹਮਣੇ ਵਾਲੇ ਵਿਅਕਤੀ ਵੱਲੋਂ ਜਾਂ ਟੀਚਰ ਵੱਲੋਂ ਅਧਿਆਪਕ ਵੱਲੋਂ ਜੋ ਵੀ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ ਉਹਨਾਂ ਨੂੰ ਬਹੁਤ ਹੀ ਜਲਦੀ ਆਪਣੀ ਭਾਸ਼ਾ ਦੇ ਵਿੱਚ ਨੋਟ ਕਰ ਲੈਂਦਾ ਹੈ ਪਰੰਤੂ ਹਾਲ ਦੇ ਟਾ ਹੁਣ ਦੇ ਟਾਈਮ ਵਿੱਚ ਹਾਲ ਦੇ ਹੀ ਸਾਲਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਵਿਦਿਆਰਥੀ ਕਾਪੀ ਜਾਂ ਪੈਨ ਦੀ ਵਰਤੋਂ ਕਰਨ ਦੀ ਥਾਂ 'ਤੇ ਮੋਬਾਈਲ ਫੋਨ ਜਾਂ ਲੈਪਟੋਪ ਦੇ ਉੱਪਰ ਸਿੱਧਾ ਹੀ ਟਾਈਪ ਕਰ ਲੈਂਦੇ ਹਨ ਇਹਦੇ ਨਾਲ ਉਹਨਾਂ ਦੀ ਟਾਈਪਿੰਗ ਸਪੀਡ ਜੋ ਹੈ ਉਹ ਬਹੁਤ ਚੰਗੀ ਬਣ ਜਾਂਦੀ ਹੈ ਅਤੇ ਤਕਨਾਲੋਜੀ ਨਾਲ ਜੇ ਕਦੇ ਤੌਰ 'ਤੇ ਜੇ ਜੇਕਰ ਦੇਖਿਆ ਜਾਵੇ ਇਹ ਇੱਕ ਚੰਗੀ ਗੱਲ ਵੀ ਹੈ ਪ੍ਰੰਤੂ ਇਹਦੇ ਵਿੱਚ ਸਮੱਸਿਆ ਇਹ ਆਉਂਦੀ ਹੈ ਕਿ ਵਿਦਿਆਰਥੀ ਸ਼ਬਦਾਂ ਦੀ ਬਣਤਰ ਵੀ ਭੁੱਲ ਜਾਂਦੇ ਹਨ ਅਤੇ ਕਈ ਕੁਛ ਔਟੋਮੈਟਿਕ ਟ੍ਰਾਂਸਲੇਸ਼ਨ ਟੂਲ ਜਾਂ ਐਰਰ ਕਰੈਕਟਿੰਗ ਦੇ ਸਾਧਨ ਜੋ ਉਹਨਾਂ ਦੇ ਵਿੱਚ ਦਿੱਤੇ ਜਾਂਦੇ ਹਨ ਉਹਨਾਂ 'ਤੇ ਨਿਰਭਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਸ਼ਬਦਾਂ ਦੇ ਸਪੈਲਿੰਗ ਭੁੱਲ ਜਾਂਦੇ ਹਨ